ਮੈਂ ਸੀ ਐੱਲ ਕੀਊ ਤੋਂ ਜਿਹੜੀ ਆਪਣੀ ਪੈਂਟ ਔਰਡਰ ਕੀਤੀ ਸੀ ਬਹੁਤ ਵਧੀਆ ਫਿਟਿੰਗ ਆਈ ਕੱਪੜਾ ਬਹੁਤ ਫਾਈਨ ਸੀ ਮੇਰਾ ਐਕਸਪੀਰੀਐਂਸ ਇਸ ਪੈਂਟ ਦੇ ਮਾਮਲੇ 'ਚ ਬਹੁਤ ਵਧੀਆ ਰਿਹਾ ਜਦੋਂ ਮੈਂ ਇਸ ਨੂੰ ਪਾਇਆ ਇੰਝ ਲੱਗਿਆ ਜਿਵੇਂ ਮੇਰਾ ਨਾਪ ਲੈ ਕੇ ਪੈਂਟ ਮੇਰੇ ਲਈ ਬਣਾਈ ਗਈ ਹੋਵੇ ਪਹਿਲਾਂ ਮੈਂ ਬਹੁਤ ਸਾਰੀਆਂ ਪੈਂਟਾਂ ਔਰਡਰ ਕੀਤੀਆਂ ਉਹ ਐਨੀਆ ਵਧੀਆ ਨਹੀਂ ਸੀ ਪਰ ਜਿਹੜੀ ਮੈਂ ਇਹ ਪੈਂਟ ਪਾਈ ਹੈ ਇਹਦਾ ਕੱਪੜਾ ਇਹਦੀ ਸਟੀਚਿੰਗ ਇਹਦੇ ਨਾਲ ਜੋ ਮੈਨੂੰ ਐਕਸਪੀਰੀਐਂਸ ਹੋ ਰਿਹਾ ਬਹੁਤ ਵਧੀਆ ਹੈ ਸੋ ਮੈਂ ਚਾਹੁੰਦਾ ਕਿ ਏਦਾਂ ਦੀਆਂ ਹੀ ਪੈਂਟਾਂ ਜਿਹੜੀਆਂ ਤੁਹਾਡੀ ਕੰਪਨੀ ਬਣਾਵੇ ਤਾਂ ਕਿ ਮੈਂ ਪਾ ਸਕਾਂ ਅਤੇ ਮੈਂ ਇਹ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਮੇਰੀ ਇਸ ਤਰ੍ਹਾਂ ਦੀਆਂ ਪੈਂਟਾਂ ਜਿਹੜੀਆਂ ਨੇ ਇਹ ਬਾਕੀ ਕੰਪਨੀਆਂ 'ਚ ਨਹੀਂ ਮਿਲਦੀਆਂ ਹਾਂ ਇਹ ਸੀ ਐੱਲ ਕੀਊ 'ਚ ਜ਼ਰੂਰ ਮਿਲਦੀਆਂ ਨੇ ਭਾਵੇਂ ਕਿ ਮਹਿੰਗੀਆਂ ਨੇ ਪਰ ਬਹੁਤ ਵਧੀਆ ਨੇ ਇਸ ਕਰਕੇ ਇਹੋ ਜਿਹੀਆਂ ਪੈਟਾਂ ਲਈ ਓਰਡਰ ਕਰਨਾ ਬਣਦਾ ਹੈ ਅਤੇ ਮੈਂ ਏਦਾਂ ਦੇ ਓਰਡਰ ਹੀ ਅੱਗੇ ਤੋਂ ਕਰਾਂਗਾ